ਸਭ ਤੋਂ ਚਣੌਤੀਪੂਰਨ ਵਿਅੰਜਨ ਜੋ ਮੈਂ ਕਿ ਕੋਸ਼ਿਸ ਕੀਤੀ ਸੀ ਉਹ ਸੀ ਮਨਚੂਰੀਅਨ ਮੈਂ ਵਿਅੰਜਨ ਦਾ ਪਹਿਲੇ ਸਾਰੀ ਰੈਸਪੀ ਦੇਖੀ ਸੀ ਅਤੇ ਜਦੋਂ ਮੈਂ ਬਣਾਉਣ ਲਈ ਮੈਨੂੰ ਬਹੁਤ ਹੀ ਜ਼ਿਆਦਾ ਔਖੀ ਲੱਗੀ ਬਿਕੌਜ਼ ਇਹਦੇ ਵਿੱਚ ਬਹੁਤ ਜ਼ਿਆਦਾ ਸਬਜ਼ੀਆਂ ਦੀ ਲੋੜ ਪੈਂਦੀ ਹੈ ਅਤੇ ਸਬਜ਼ੀਆਂ ਨੂੰ ਬਰੀਕ ਬਰੀਕ ਬਹੁਤ ਜ਼ਿਆਦਾ ਕੱਟਣਾ ਪੈਂਦਾ ਬੜੀ ਜ਼ਿਆਦਾ ਸੋਸਿਸ ਦੀ ਲੋੜ ਪੈਂਦੀ ਹੈ ਅਤੇ ਉਹ ਸੋਸਿਸ ਨੂੰ ਕਿਸ ਮਾਤਰਾ 'ਚ ਏ ਉਸ ਚੀਜ਼ ਵਿੱਚ ਪਾਣਾ ਤਾਂ ਉਹ ਵੀ ਬੜਾ ਮੈਟਰ ਕਰਦਾ ਹੈ ਇਸ ਦੌਰਾਨ ਬਣਾਉਂਦੇ ਹੋਏ ਮੇਰੀ ਕਾਫ਼ੀ ਵੇਸਟੇਜ਼ ਹੋਈ ਚੀਜ਼ਾਂ ਦੀ ਅਤੇ ਬਹੁਤ ਜ਼ਿਆਦਾ ਸੋਸ ਉੱਪਰ ਥੱਲੇ ਉਹ ਵੀ ਵੇਸਟ ਹੋਈਆਂ ਅਤੇ ਕਿਸ ਮਾਤਰਾ 'ਚ ਆਪਾਂ ਉਹਦੀ ਗ੍ਰੇਵੀ ਬਣਾਉਣੀ ਹੈ ਪਹਿਲੇ ਬੋਲਸ ਬਣਾਉਣੇ ਹੈ ਉਹ ਸਬਜ਼ੀ ਨੂੰ ਪਹਿਲੇ ਆਟੇ 'ਚ ਗੁੰਨਣਾ ਹੈ ਔਰ ਫਿਰ ਬੋਲਸ ਬਣਾਉਣੇ ਉਹਨਾਂ ਨੂੰ ਫਾਰਈ ਕਰਨਾ ਹੈ ਅਤੇ ਉਸਦੇ ਆਗੇ ਜਾ ਕੇ ਗ੍ਰੇਵੀ ਬਣਾਉਣੀ ਹੈ ਗ੍ਰੇਵੀ 'ਚ ਵੀ ਬਹੁਤ ਬਰੀਕ ਬਰੀਕ ਸਬਜ਼ੀਆਂ ਸਾਰੀਆਂ ਪਾਣੀ ਹਨ ਸੋਸਿਸ ਪਾਣੀ ਹੈ ਅਤੇ ਉਹਨੂੰ ਥਿਕ ਬਣਾਉਣਾ ਹੈ ਅਤੇ ਬੜੀ ਚੀਜ਼ਾਂ ਪਾ ਪੂ ਕੇ ਜੇ ਮੈਂ ਉਹਨੂੰ ਬਣਾਇਆ ਤਾਂ ਮੇਰੀ ਕਾਫ਼ੀ ਚੀਜ਼ਾਂ ਦੀ ਬਹੁਤ ਜ਼ਿਆਦਾ ਵੇਸਟੇਜ਼ ਹੋਏ ਇੱਕ ਜੋ ਕਿ ਮੇਨ ਹੈ ਕਿ ਮਿਹਨਤ ਬਹੁਤ ਜ਼ਿਆਦਾ ਲੱਗੀ ਉਸ ਚੀਜ਼ ਨੂੰ ਬਣਾਉਣ ਵਿੱਚ ਅਤੇ ਖਾਣ ਵਿੱਚ ਐਂਡ 'ਤੇ ਮੈਂ ਉਹਨੂੰ ਚੰਗੀ ਤਰ੍ਹਾਂ ਮਤਲਬ ਬਣ ਗਈ ਸੀ ਬਟ ਮੈਂ ਉਸ ਤੋਂ ਇਹ ਸਿੱਖਿਆ ਕਿ ਇਹ ਚੀਜ਼ਾਂ ਦੀ ਬਹੁਤ ਵੇਸਟੇਜ਼ ਕਰਨ ਨਾਲੋਂ ਚੰਗਾ ਹੈ ਕਿ ਆਪਾਂ ਜਿਹੜੀ ਸਹੀ ਇਜ਼ੀ ਰੈਸਪੀ ਹੈਗੀ ਉਹ ਆਪਾਂ ਚੁਣ ਸਕਦੇ ਹਨ ਇਹਦੇ ਵਿੱਚ ਇਹ ਹੈ ਕਿ ਸਾਡੀ ਬਹੁਤ ਜ਼ਿਆਦਾ ਚੀਜ਼ਾਂ ਦੀ ਵੇਸਟੇਜ਼ ਚਲਦੀ ਗਈ ਅਤੇ ਜੋ ਕਿ ਮੈਨੂੰ ਨਹੀਂ ਪਸੰਦ ਆਇਆ ਬਟ ਐਂਡ 'ਤੇ ਮੈਂ ਬਹੁਤ ਵਧੀਆ ਮਨਚੂਰੀਅਨ ਬਣਾ ਲਈ ਸੀ ਅਤੇ ਬਹੁਤ ਜ਼ਿਆਦਾ ਔਖੀ ਰੈਸਪੀ ਮੇਰੀ ਚਣੌਤੀਪੂਰਨ ਵਿਅੰਜਨ ਦੀ ਇਹ ਹੀ ਮਨਚੂਰੀਅਨ ਦੀ ਸੀ ਕਿ ਜੋ ਕਿ ਮੈਂ ਪੂਰੀ ਕੀਤੀ ਐਂਡ 'ਤੇ ਬਹੁਤ ਸਵਾਦ ਬਣ ਗਈ ਸੀ